ਆਵਾਜਾਈ ਦੇ ਜਿਹੜੇ ਆਮ ਢੰਗ ਸਨ ਉਹ ਬੁਹਤ ਹੀ ਮਤਲਬ ਵਰਤੇ ਹੋਏ ਸਨ ਕਿ ਜਿਵੇਂ ਤੁਸੀਂ ਆਮ ਯਾਤਰਾ ਕਰਦੇ ਸਨ ਆਮ ਅਸੀਂ ਪ੍ਰਾਈਵੇਟ ਬੱਸਾਂ 'ਤੇ ਸਰਕਾਰੀ ਬੱਸਾਂ 'ਤੇ ਜਾਂਦੇ ਸਨ ਜਿਵੇਂ ਕਿ ਆਮ ਜਗ੍ਹਾ 'ਤੇ ਜਿਵੇਂ ਯਾਤਰਾ ਕਰੀ ਜਾਂਦੀ ਹੈ ਜਾਂ ਆਮ ਪ੍ਰਾਈਵੇਟ ਬੱਸਾਂ 'ਤੇ ਅਤੇ ਸਰਕਾਰੀ ਬੱਸਾਂ 'ਤੇ ਕਰਦੇ ਸਾਂ ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਮਤਲਬ ਗਰਮੀ ਜੀ ਦਾ ਮੌਸਮ ਵੀ ਹੁੰਦਾ ਹੈ ਕਿਸੇ ਵੇਲੇ ਬਹੁਤ ਠੰਡ ਵੀ ਹੁੰਦੀ ਹੈਗੀ ਅਤੇ ਇਹਦੇ ਵਿੱਚ ਜਿਹੜਾ ਕਿ ਬਹੁਤ ਥਕਾਵਟ ਹੋ ਜਾਂਦੀ ਹੈਗੀ ਅਤੇ ਇਹ ਜਿਹੜੇ ਮਤਲਬ ਆਮ ਜਿਹੜੇ ਹੁੰਦੇ ਹੈਗੇ ਯਾਤਰਾ ਹੁੰਦੀ ਹੈਗੀ ਇਹਦੇ ਵਿੱਚ ਜ਼ਿਆਦਾ ਇੰਨਾ ਮਤਲਬ ਕੰਫਰਟੇਬਲ ਫੀਲ ਨਹੀਂ ਹੁੰਦਾ ਹੈਗਾ ਇੰਨਾ ਵਧੀਆ ਨਹੀਂ ਹੁੰਦਾ ਗਾ ਅਤੇ ਜਿਹੜੀ ਮਤਲਬ ਅਸੀਂ ਇੱਕ ਮੈਰ ਪਹਿਲਾਂ ਮੈਂ ਕੁਝ ਸਾਲ ਪਹਿਲਾਂ ਜਦੋਂ ਕਿ ਮੇਰੀ ਏਜ ਹੈਗੀ ਸੀ ਪੰਦਰਾਂ ਸੋਲਾਂ ਸਾਲ ਦੀ ਸੀਗੀ ਉਦੋਂ ਅਸੀਂ ਫੈਮਿਲੀ ਟ੍ਰਿਪ ਗਏ ਸੀਗੇ ਉੱਥੇ ਕਾਰ 'ਤੇ ਗਏ ਸੀਗੇ ਆਪਣੀ ਖੁਦ ਦੀ ਕਾਰ 'ਤੇ ਗਏ ਸੀਗੇ ਬਹੁਤ ਹੀ ਵਧੀਆ ਮਤਲਬ ਯਾਦਗਾਰ ਟ੍ਰਿਪ ਰਿਹਾ ਸੀ ਉਹਦੇ ਸਭ ਤੋਂ ਪਹਿਲਾਂ ਅਸੀਂ ਜਦੋਂ ਅੰਮ੍ਰਿਤਸਰ ਮੱਥਾ ਟੇਕਣ ਗਏ ਸੀਗੇ ਇੱਥੋਂ ਬਠਿੰਡੇ ਤੋਂ ਅਤੇ ਬਹੁਤ ਹੀ ਵਧੀਆ ਯਾਦਗਾਰ ਟ੍ਰਿਪ ਹੈ ਉੱਥੇ ਜਾ ਕੇ ਅਸੀਂ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਮੱਥਾ ਟੇਕਿਆ ਪਹਿ ਸਭ ਤੋਂ ਪਹਿਲਾਂ ਅਸੀਂ ਇਸਨਾਨ ਕਰਿਆ ਫਿਰ ਅਸੀਂ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਉਹ ਜਿਲ੍ਹਿਆ ਵਾਲਾ ਬਾਗ ਵੀ ਗਏ ਸੀਗੇ ਲੰਗਰ ਵੀ ਛਕਿਆ ਸੀਗਾ ਬਹੁਤ ਵਧੀਆ ਮਤਲਬ ਘੁੰਮੇ ਸੀਗੇ ਮਤਲਬ ਆਪ ਦਾ ਖੁਦ ਦਾ ਜਿਹੜਾ ਮਤਲਬ ਵਾਹਣ ਹੁੰਦਾ ਖੁਦ ਦੇ ਵਾਹਣ 'ਤੇ ਜਦੋਂ ਅਸੀਂ ਯਾਤਰਾ ਕਰਨ ਜਾਂਦੇ ਹਾਂ ਤਾਂ ਬਹੁਤ ਵਧੀਆ ਲੱਗਦਾ ਹੈਗਾ ਕੰਫਰਟੇਬਲ ਲੱਗਦਾ ਵਾ ਨਾਲੇ ਅਸੀਂ ਖੁੱਲ੍ਹੇ ਟੈਮ ਵਾਸਤੇ ਜਾਂਦੇ ਹੈਗੇ ਆਪਣੇ ਵਾਸਤੇ ਵੀ ਜ਼ਿਆਦਾ ਘੁੰਮ ਸਕਦੇ ਹੈਗੇ ਜ਼ਿਆਦਾ ਵਧੀਆ ਘੁੰਮ ਫਿਰ ਸਕਦੇ ਹਾਂ ਆਪਣੇ ਯਾਦਗਾਰ ਪਲ ਜਿਹੜੇ ਉਹ ਕੈਚ ਕਰ ਸਕਦੇ ਹਾਂ ਵਧੀਆ ਮਤਲਬ ਵਧੀਆ ਰਹਿੰਦੇ ਸਨ ਇਹ ਸਾਡਾ ਬਹੁਤ ਹੀ ਯਾਦਗਾਰ ਟ੍ਰਿਪ ਹੈ ਮੇਰਾ ਬਹੁਤ ਹੀ ਜ਼ਿੰਦਗੀ ਦਾ ਵਧੀਆ ਅਤੇ ਯਾਦਗਾਰ ਟ੍ਰਿਪ ਹੈ ਇਹਨੂੰ ਮੈਂ ਕਦੇ ਨਹੀਂ ਭੁੱਲਾਂਗਾ ਥੈਂਕ ਯੂ ਸੌ ਮੱਚ